ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਲਈ ਅਤੇ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਬਹੁਤ ਪ੍ਰੋਗਰਾਮ ਚਲਾਏ ਹਨ ਅਤੇ ਪ੍ਰੋਜੈਕਟ ਚਲਾਏ ਹਨ ਇੱਥੋਂ ਤੱਕ ਕਿ ਯੂਥ ਵੀ ਇਸ ਚੀਜ਼ ਨੂੰ ਪ੍ਰਮੋਟ ਕਰ ਰਿਹਾ ਅਤੇ ਵਿਦੇਸ਼ਾਂ ਵਿਦੇਸ਼ਾਂ ਵਿੱਚ ਵੀ ਪੜ੍ਹਾਈ ਇਹ ਪੰਜਾਬੀ ਪੜ੍ਹਾਈ ਜਾ ਰਹੀ ਹੈ ਅੱਜ ਕੱਲ੍ਹ ਪੰਜਾਬੀ ਪੜ੍ਹਾਉਣ 'ਤੇ ਕੋਈ ਫਾਈਨ ਨਹੀਂ ਲੱਗਦਾ ਸਕੂਲਾਂ 'ਚ ਬੇਜਰਿਕ ਪੜ੍ਹਾਈ ਜਾ ਰਹੀ ਨਾ ਕਿ ਕੇਵਲ ਪੰਜਾਬ 'ਚ ਇਹ ਭਾਸ਼ਾ ਪੜ੍ਹਾਈ ਜਾ ਰਹੀ ਹੈ ਕਿ ਦੂਸਰੀਆਂ ਸਟੇਟਾਂ ਵਿੱਚ ਵੀ ਇਸ ਦਾ ਬੱਚਿਆਂ ਨੂੰ ਅਭਿਆਸ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਆਪਣੀ ਪੰਜਾਬੀ ਭਾਸ਼ਾ ਮਾਂ ਬੋਲੀ ਨਾਲ ਜਾਣੂ ਹੋ ਸਕਣ ਅਤੇ ਬੱਚੇ ਵੀ ਇਸਨੂੰ ਬਹੁਤ ਉਸ਼ਤ ਉਤਸ਼ਾਹਿਤ ਹੋ ਕੇ ਪੜ੍ਹਦੇ ਹਨ ਅਤੇ ਬੋਰਡ ਸਾਰੇ ਜੋ ਵੀ ਗੋਵਰਮੈਂਟ ਨੇ ਜਿੰਨੇ ਵੀ ਬੋਰਡ ਲਵਾਏ ਨੇ ਪੰਜਾਬ ਦੇ ਵਿੱਚ ਉਹ ਸਾਰੇ ਪੰਜਾਬੀ ਭਾਸ਼ਾ ਵਿੱਚ ਲਵਾਏ ਹਨ ਕਿਉਂਕਿ ਪਿਛਲੇ ਸਮਿਆਂ ਵਿੱਚ ਸਾਰੇ ਬੋਰਡ ਇੰਗਲਿਸ਼ ਅਤੇ ਹਿੰਦੀ 'ਚ ਲੱਗਣ ਲੱਗ ਗਏ ਸੀ ਅਤੇ ਸਕੂਲਾਂ ਦੇ ਵਿੱਚ ਵੀ ਬੱਚਿਆਂ ਕੋਲੋਂ ਹਿੰਦੀ ਅਤੇ ਇੰਗਲਿਸ਼ ਹੀ ਪੜ੍ਹਵਾਈ ਜਾਂਦੀ ਸੀ ਅਤੇ ਉਹਨਾਂ ਉਹ ਪ੍ਰਮੋਟ ਹੀ ਇੰਗਲਿਸ਼ ਅਤੇ ਹਿੰਦੀ ਨੂੰ ਕਰ ਰਹੇ ਸੀ ਹੁਣ ਇਸ ਟਾਈਮ ਗੋਵਰਮੈਂਟ ਸਾਰੀ ਸਕੂਲਾਂ 'ਚ ਉਹਨਾਂ ਨੇ ਪੰਜਾਬੀ ਲਾਜ਼ਮੀ ਕਰ ਦਿੱਤੀ ਹੈ ਅਤੇ ਸਾਰੇ ਪਾਸੇ ਪੰਜਾਬੀ ਪੜ੍ਹਾਈ ਜਾ ਰਹੀ ਹੈ ਅਤੇ ਬੋਰਡ ਵੀ ਪੰਜਾਬੀ ਵਿੱਚ ਕਰ ਦਿੱਤੇ ਗਏ ਹਨ ਤਾਂ ਜੋ ਕਿ ਦੂਜੇ ਨੂੰ ਪਤਾ ਲੱਗੇ ਕਿ ਇਹ ਪੰਜਾਬ ਆ